ਰੋਪੜ ਜ਼ਿਲ੍ਹੇ ਵਿੱਚ ਬਹੁਤ ਪੁਰਾਣਾ ਰੇਲਵੇ ਸਟੇਸ਼ਨ ਹੈ ਜਿੱਥੋਂ ਤੋਂ ਹਿਮਾਚਲ ਨੂੰ ਵੀ ਜਾਣ ਨੂੰ ਸਾਨੂੰ ਸੌਖਾ ਹੈ ਅਤੇ ਦਿੱਲੀ ਚੰਡੀਗੜ੍ਹ ਜਾਣ ਨੂੰ ਵੀ ਸੌਖਾ ਹੈ ਅਤੇ ਇੱਥੋਂ ਹੁਣ ਨਵੀਂ ਬੰਦੇਮਾਤਰਮ ਪ੍ਰਧਾਨ ਮੰਤਰੀ ਜੀ ਨੇ ਗ ਰੇਲ ਗੱਡੀ ਸ਼ੁਰੂ ਕੀਤੀ ਹੈ ਜੋ ਕਿ ਦਿੱਲੀ 'ਚ ਤਿੰਨ ਚਾਰ ਘੰਟੇ ਵਿੱਚ ਹੀ ਪਹੁੰਚ ਜਾਂਦੀ ਹੈ ਅਤੇ ਰੇਲ ਰਾਹੀਂ ਸਾਨੂੰ ਬਹੁਤ ਸਹੂਲਤਾਂ ਮਿਲੀਆਂ ਹਨ ਇੱਥੋਂ ਬਹੁਤ ਪੁਰਾਣੀ ਗੱਡੀ ਨੰਗਲ ਟੂ ਦਿੱਲੀ ਵਾਇਆ ਸ਼ਾਨਪੁਰ ਜਾਂਦੀ ਸੀ ਅਤੇ ਉਸ ਰਾਹੀਂ ਵੀ ਲੋਕ ਬਹੁਤ ਸਫਰ ਕਰਦੇ ਸਨ ਅਤੇ ਹੁਣ ਵੀ ਹੋਰ ਵੀ ਬਹੁਤ ਨਵੀਆਂ ਗੱਡੀਆਂ ਲੱਗ ਗਈਆਂ ਹਨ ਅਤੇ ਕਿਸੇ ਨੂੰ ਵੀ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਂਦੀ ਅਤੇ ਇੱਥੇ ਬ ਬੱਸ ਹ ਬਹੁਤ ਬੜਾ ਬੱਸ ਅੱਡਾ ਹੈ ਅਤੇ ਬੱਸਾਂ ਦੀ ਵੀ ਹਰ ਜ਼ਿਲ੍ਹੇ ਨੂੰ ਜਾਣ ਲਈ ਸਹੂਲਤ ਹੈ ਅਤੇ ਚਾਹੇ ਅੰਮ੍ਰਿਤਸਰ ਚਲੇ ਜੋ ਗੁਰਦਾਸਪੁਰ ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਅਤੇ ਦਿੱਲੀ ਚੰਡੀਗੜ੍ਹ ਅਤੇ ਇੱਧਰ ਲੁਧਿਆਣੇ ਕਿਸੇ ਪਾਸੇ ਵੀ ਤੁਸੀਂ ਜਾ ਸਕਦੇ ਹਾਂ ਅਤੇ ਰੋਪੜ ਜ਼ਿਲ੍ਹੇ ਦੀਆਂ ਸੜਕਾਂ ਵੀ ਬਹੁਤ ਵਧੀਆ ਅਤੇ ਬਾਈਪਾਸ ਬਣੇ ਹੋਏ ਹਨ ਫਲਾਈਓਵਰ ਬਣੇ ਹੋਏ ਹਨ ਕਿਸੇ ਵੀ ਟਰੈਫਿਕ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਇੱਥੇ ਥਰੀ ਵੀਲਰ ਕਾਰਾਂ ਪ੍ਰਾਈਵੇਟ ਚੱਲਦੀਆਂ ਹਨ ਕਿਸੇ ਮੁਸਾਫਿਰ ਨੂੰ ਵੀ ਕੋਈ ਇੱਕ ਮਿੰਟ ਖੜ੍ਹਨ ਦੀ ਲੋੜ ਨਹੀਂ ਪੈਂਦੀ ਸਾਫ ਸੁਥਰੀਆਂ ਸੜਕਾਂ ਹਨ ਅਤੇ ਇ ਇੱਥੇ ਇਸ ਕਰਕੇ ਬਿਜ਼ਨਸ ਵੀ ਬਹੁਤ ਜ਼ਿਆਦਾ ਵਧੀਆ ਚੱਲਦਾ ਹੈ